ਹੈਲੋ ਨਮਸਕਾਰ ਸਰ ਮੈਂ ਘਰ ਤੋਂ ਨਵਾਂ ਕੰਮ ਸਟਾਰਟ ਕੀਤਾ ਇਹਦੇ ਲਈ ਮੈਨੂੰ ਡਾਟਾ ਘੱਟ ਮਿਲ ਰਿਹਾ ਅਤੇ ਹਾਂਜੀ ਠੀਕ ਹੈ ਜੀ ਨਹੀਂ ਵਾਈਫਾਈ ਨਹੀਂ ਮੈਂ ਮੈਸ਼ਨ ਨਹੀਂ ਕਰ ਸਕਦਾ ਇੰਨੀ ਮੇਰੀ ਇਨਕਮ ਹੈ ਨਹੀਂ ਹਾਂਜੀ ਹਾਂਜੀ ਨਹੀਂ ਕੋਈ ਸਕੀਮ ਕੋਈ ਨਿਊ ਸਕੀਮ ਆਉਣ ਵਾਲੀ ਹੋਵੇ ਜਾਂ ਆਈ ਹੋਵੇ ਜਾਂ ਤੁਹਾਡੇ ਜਹਿਨ 'ਚ ਹੋਵੇ ਹਾਂਜੀ ਹਾਂਜੀ ਮੈਂ ਘਰ ਤੋਂ ਹੀ ਸ਼ੁਰੂ ਕੀਤਾ ਜੀ ਮੈਨੂੰ ਡਾਟਾ ਘੱਟ ਮਿਲਦਾ ਪਿਆ